ਇੱਕ ਜਨਵਰੀ ਉੱਨੀ ਸੌ ਚੁਰਾਨਵੇਂ ਗਿਆਰਾਂ ਫਰਵਰੀ ਉੱਨੀ ਸੌ ਤ੍ਰਿਆਨਵੇਂ ਅੱਠ ਮਾਰਚ ਉੱਨੀ ਸੌ ਨੜਿਨਵੇਂ ਗਿਆਰਾਂ ਨਵੰਬਰ ਉੱਨੀ ਸੌ ਤੇਈ ਬਾਰਾਂ ਜੁਲਾਈ ਦੋ ਹਜ਼ਾਰ ਤੇਈ